ਮੈਨੂੰ ਆਪਣੀ ਪਸੰਦੀਦਾ ਸ਼ੈਲੀਆਂ ਵਿੱਚ ਇਤਿਹਾਸ ਅਤੇ ਰਾਜਨੀਤੀ ਦੀਆਂ ਕਿਤਾਬਾਂ ਅਤੇ ਰਾਜਨੀਤੀ ਦੀ ਸਮਝ ਅਤੇ ਇਤਿਹਾਸ ਦੀ ਸਮਝ ਕਰਨਾ ਇਹ ਬਹੁਤ ਹੀ ਅੱਛਾ ਲੱਗਦਾ ਹੈ ਇਹਨਾਂ ਦੋਹਾਂ ਦੇ ਵਿੱਚ ਮੇਰਾ ਜਿਹੜਾ ਮਨ ਹੈ ਉਹ ਬਹੁਤ ਹੀ ਲੱਗਦਾ ਹੈ ਅਤੇ ਇਹ ਦੋਨੇ ਹੀ ਸ਼ੈਲੀਆਂ ਮੈਨੂੰ ਬਹੁਤ ਪਸੰਦ ਕ ਲੱਗਦੀਆਂ ਹਨ ਪਰ ਇਹਨਾਂ ਸ਼ੈਲੀਆਂ ਦੇ ਵਿੱਚੋਂ ਜੇਕਰ ਮੈਨੂੰ ਸਾਰੀ ਜ਼ਿੰਦਗੀ ਵਾਸਤੇ ਇੱਕ ਹੀ ਸ਼ੈਲੀ ਦੇ ਉੱਤੇ ਕਿਤਾਬਾਂ ਪੜ੍ਹਨ ਦਾ ਮੌਕਾ ਮਿਲੇ ਤਾਂ ਮੈਂ ਉਹ ਕਿਤਾਬਾਂ ਸਿਰਫ ਤੇ ਸਿਰਫ ਇਤਿਹਾਸ ਦੇ ਬਾਰੇ ਪਤਾ ਕਰਨ ਉਹਨੂੰ ਸਮਝਣ ਅਤੇ ਉਹਦੇ ਬਾਰੇ ਅਧਿਐਨ ਕਰਨ ਬਾਰੇ ਇੱਕੋ ਹੀ ਇਤਿਹਾਸ ਦੇ ਬਾਰੇ ਸਮਝਣ ਵਾਸਤੇ ਲਗਾ ਸਕਦਾ ਹਾਂ ਹਾਲ ਹੀ ਦੇ ਵਿੱਚ ਮੈਂ ਇੱਕ ਕਿਤਾਬ ਜੋ ਕਿ ਖਾਲਸਾ ਰਾਜ ਦੇ ਉਦੈ ਹੋਣ ਦੇ ਉੱਤੇ ਲਿਖੀ ਗਈ ਸੀ ਅਤੇ ਉਹਦੇ ਡੁੱਬਣ ਦੇ ਉੱਤੇ ਲਿਖੀ ਗਈ ਸੀ ਉਹਦੇ ਉਹਨੂੰ ਪੜ੍ਹਿਆ ਹੈ ਅਤੇ ਉਹਦਾ ਅਧਿਐਨ ਕੀਤਾ ਹੈ ਇਹ ਕਿਤਾਬ ਦੇ ਵਿੱਚ ਰਾਜਨੀਤੀ ਤੋਂ ਲੱਗ ਕੇ ਅਤੇ ਉਸ ਰਾਜਨੀਤੀ ਦੇ ਹੋਏ ਨਫੇ ਨੁਕਸਾਨ ਦੇ ਉੱਤੇ ਅਤੇ ਸਾਰਾ ਹੀ ਉਸ ਪੂਰੇ ਹੀ ਖਾਲਸਾ ਰਾਜ ਦੇ ਚੜ੍ਹਾਈ ਤੋਂ ਲੱਗ ਕੇ ਡੁੱਬਣ ਤੱਕ ਦੇ ਪੂਰੇ ਸਫਰ ਨੂੰ ਲਿਖਿਆ ਗਿਆ ਹੈ ਇਸ ਸਫਰ ਨੂੰ ਮੈਂ ਚੰਗੀ ਤਰ੍ਹਾਂ ਸਮਝ ਅਤੇ ਅਧਿਐਨ ਕਰਨ ਤੋਂ ਬਾਅਦ ਇਹ ਸਮਝਿਆ ਹੈ ਕਿ ਇਤਿਹਾਸ ਦੇ ਵਿੱਚ ਸਮਝਦਾਰੀ ਅਤੇ ਸਮਝਦਾਰੀ ਅਤੇ ਅਧਿਐਨ ਹੋਣਾ ਹੀ ਸਭ ਤੋਂ ਵੱਡੀ ਸ ਸ਼ੈਲੀ ਹੈ